ਹਾਂਜੀ ਸਾਡੇ ਖੇਤਰ ਵਿੱਚ ਇੱਥੇ ਨਾ ਬਹੁਤ ਜ਼ਿਆਦਾ ਸਪੋਰਟਸ ਕਲੱਬ ਨੇ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਸਪੋਰਟਸ ਦੇ ਪ੍ਰਤੀ ਜਾਗਰੂਕ ਹੋਏ ਹੋਏ ਨੇ ਜਿਵੇਂ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਿਜ ਆ ਉੱਥੇ ਸਪੋਰਟਸ ਦਾ ਜਿਹੜਾ ਕਲੱਬ ਬਣਿਆ ਹੋਇਆ ਨਾ ਉੱਥੇ ਬਹੁਤ ਜ਼ਿਆਦਾ ਸਹੂਲਤਾਂ ਨੇ ਜਿਵੇਂ ਉੱਥੇ ਟਰੈਕ ਐਂਡ ਫੀਲਡ ਦੇ ਸਾਰੇ ਕੰਪੀਟੀਸ਼ਨ ਹੁੰਦੇ ਨੇ ਫੁੱਟਬਾਲ ਗਰਾਊਂਡ ਬਣਿਆ ਹੋਇਆ ਹੋਕੀ ਗਰਾਊਂਡ ਨੇ ਬਾਸਕਿਟਬਾਲ ਨੇ ਵੋਲੀਬੋਲ ਆ ਠੀਕ ਆ ਉਹਦੇ ਵਿੱਚ ਲਾਨ ਟੈਨਿਸ ਦੇ ਵੀ ਸਾਡੇ ਕੋਟ ਬਣੇ ਹੋਏ ਨੇ ਠੀਕ ਆ ਜੀ ਅਤੇ ਕਬੱਡੀ ਦੇ ਕੋਟ ਨੇ ਅਤੇ ਇਸ ਤੋਂ ਇਲਾਵਾ ਸਾਡੇ ਇੱਕ ਜਮਨੇਜੀਅਮ ਬਣਿਆ ਹੋਇਆ ਉਹਦੇ ਅੰਦਰ ਇਨਡੋਰ ਗੇਮਸ ਹੁੰਦੀਆਂ ਨੇ ਜਿਵੇਂ ਬੈਡਮਿੰਟਨ ਲਾ ਲਉ ਇਹ ਤੋਂ ਇਲਾਵਾ ਵੀ ਸਾਡੇ ਇੱਕ ਜ ਫਿਟਨੈਸ ਸੈਂਟਰ ਬਣਿਆ ਹੋਇਆ ਉੱਥੇ ਉੱਪਰ ਤਾਂ ਉਹਦੇ ਜਿਹੜੀ ਹੈਗੀ ਆ ਜਿੰਮ ਉਹਦਾ ਸੈਟ ਅਪ ਕੀਤਾ ਹੋਇਆ ਨੀਚੇ ਬਹੁਤ ਵੱਡਾ ਸਵੀਮਿੰਗ ਪੂਲ ਆ ਜਿਹੜਾ ਉਹ ਬਣਿਆ ਹੋਇਆ ਸਾਰੇ ਬੱਚੇ ਉਹਦਾ ਸਹੂਲਤਾਂ ਨੇ ਜਿਹੜੀਆਂ ਇਹਨਾਂ ਦਾ ਉਹ ਫਾਇਦਾ ਲੈਂਦੇ ਨੇ ਅਤੇ ਆਪਣੇ ਆਪ ਨੂੰ ਫਿਟ ਰੱਖਦੇ ਨੇ